ਪੰਜਾਬ ਵਿਚ ਆਪਾਂ ਦੇਖੀਏ ਤਾਂ ਕਾਨੂੰਨ ਰੁਜ਼ਗਾਰ ਕਿਰਤ ਦੇ ਮੁੱਦਿਆਂ 'ਤੇ ਬਹੁਤ ਆਸਾਨੀ ਤਰੀਕੇ ਨਾਲ ਹੈਲਪ ਕਰਦੇ ਕਿਉਂਕਿ ਸਰਕਾਰ ਨੇ ਹਰੇਕ ਵਾਸਤੇ ਇੱਕ ਅਲੱਗ ਅਲੱਗ ਪ੍ਰੋਸੀਜਰ ਬਣਾਇਆ ਹੋਇਆ ਵਾ ਜਿਵੇਂ ਵਰਕਿੰਗ ਆਵਰ ਦੇਖੀਏ ਤਾਂ ਅੱਠ ਘੰਟੇ ਦੀ ਵਰਕਿੰਗ ਆਵਰ ਹਰੇਕ ਲੇਬਰ ਨੂੰ ਅੱਠ ਘੰਟੇ ਦੀ ਜੋਬ ਕਰਨ ਦੀ ਹੈ ਔਰ ਆਪਾਂ ਅੱਠ ਘੰਟੇ ਤੋਂ ਬਾਅਦ ਆਪਾਂ ਕਿਸੇ ਨੂੰ ਕੰਪੈੱਲ ਨਹੀਂ ਕਰ ਸਕਦੇ ਕਿ ਉਹ ਕਿੰਨੇ ਘੰਟੇ ਜੋਬ ਕਰਦਾ ਹਾਂ ਉਹਦੀ ਇੱਛਾ ਹੁੰਦੀ ਉਹ ਆਪਣੇ ਕਿਉਂਕਿ ਉਹਦੇ ਵਾਸਤੇ ਉਹਨੂੰ ਪੇ ਕੀਤਾ ਜਾਂਦਾ ਅਤੇ ਉਹ ਆਪਣੀ ਮਰਜ਼ੀ ਨਾਲ ਉਹ ਅੱਠ ਤੋਂ ਬਾਰਾਂ ਘੰਟੇ ਜੋਬ ਕਰ ਸਕਦਾ ਪਰ ਉਹਦਾ ਅ ਬੈਨੀਫਿਟ ਮਿਲਦਾ ਪਰ ਕਿਸੇ ਵੀ ਬੰਦੇ ਨੂੰ ਕਾਨੂੰਨ ਦੇ ਦਾਇਰੇ ਵਿੱਚ ਰਹਿ ਕੇ ਅੱਠ ਘੰਟੇ ਤੋਂ ਬਾਅਦ ਉਸਦੀ ਮਰਜ਼ੀ ਦੇ ਖਿਲਾਫ਼ ਕੰਮ ਨਹੀਂ ਕਰਵਾਇਆ ਜਾ ਸਕਦਾ ਅਗਰ ਇਸ ਤਰ੍ਹਾਂ ਦਾ ਕੋਈ ਕੰਪਲੇਂਟ ਹੋਵੇਗਾ ਤਾ ਸਰਕਾਰ ਉਹਦੇ ਉੱਤੇ ਐਕਸਨ ਲੈਂਦੀ ਹੈ ਇਸ ਕਰਕੇ ਕਾਫੀ ਵਰਕਿੰਗ ਆਵਰ ਹੈ ਇਸ ਤਰ੍ਹਾਂ ਇੰਡਸਟ੍ਰੀਅਲ ਲੇਵਰ ਡਿਸਪਿਊਟ ਦੇ ਵਿੱਚ ਦੇਖੀਏ ਤਾਂ ਆਪਾਂ ਸਰਕਾਰ ਨੇ ਲੇਬਰ ਲੋ ਬਾਰੇ ਕਾਫੀ ਅੱਛਾ ਕਾਨੂੰਨ ਬਣਾਏ ਹੋਏ ਆ ਲੇਵਰ ਦੇ ਵਿੱਚ ਆ ਰਹੀ ਪ੍ਰੋਬਲਮ ਨੂੰ ਦੂਰ ਕਰਨ ਵਾਸਤੇ ਨੇ ਵੀ ਲੇਵਰ ਕਮਿਸ਼ਨਰ ਨੂੰ ਕੀਤਾ ਹੋਇਆ ਵਾ ਕੋਈ ਵੀ ਬੰਦਾ ਕਿਸੇ ਤਰ੍ਹਾਂ ਵੀ ਨਹੀਂ ਇੰਡਸਟਰੀ ਦੇ ਵਿੱਚ ਜਾਂ ਕਿਸੇ ਵੀ ਜਗ੍ਹਾ ਥਾਂ 'ਤੇ ਕੰਮ ਕਰਦੇ ਹੋ ਕੋਈ ਪ੍ਰੋਬਲਮ ਆਉਂਦੀ ਹੈ ਤਾਂ ਉਹ ਇੱਕ ਕੰਪਲੇਂਟ ਕਰਦਾ ਲੇਵਰ ਲੋਅ ਦੇ ਵਿੱਚ ਲੇਬਰ ਲੋਅ ਫਿਰ ਉਹਨੂੰ ਪੂਰਾ ਦੇਖਦੀ ਹੈ ਕਮਿਸ਼ਨਰ ਕਮਿਸ਼ਨਰ ਦੇ ਅੰਦਰ ਰਹਿੰਦਾ ਫਿਰ ਉਹ ਸਾਰਾ ਪ੍ਰਕਿਰਿਆ ਨੂੰ ਫੋਲੋ ਕਰਦੇ ਹੋਏ ਉਸਨੂੰ ਇਨਸਾਫ ਦਵਾਉਂਦੇ ਆ ਔਰ ਵੀ ਬਹੁਤ ਸਾਰੀ ਬੈਨੀਫਿਟਸ ਆ ਜਿਹੜੇ ਕਿ ਲੇਵਰ ਲੋਅ ਦੇ ਤਹਿਤ ਹੁੰਦਾ ਹੈ ਇਸ ਬਹੁਤ ਸਾਰੀ ਕਾਨੂੰਨੀ ਸਹਾਇਤਾ ਵੀ ਮਿਲਦੀ ਹੈ ਬਹੁਤ ਸਾਰੇ ਬੈਨੀਫਿਟਸ ਆ ਜਿਹੜੇ ਕਿ ਇੰਡਸਟਰੀ ਵਾਲੇ ਨਹੀਂ ਦਿੰਦੇ ਲੇਵਰ ਨੂੰ ਤੋ ਲੇਬਰ ਕਮਿਸ਼ਨਰ ਲੇਬਰ ਲੋਅ ਦੇ ਅਕੋਰਡਿੰਗ ਉਹਨਾਂ ਨੂੰ ਉਹ ਇੰਡਸਟਰੀ ਨੂੰ ਅਤੇ ਉਹ ਫਰਮ ਤੋਂ ਉਸ ਮਜ਼ਦੂਰ ਨੂੰ ਦਵਾਉਂਦੇ ਗੇ ਠੀਕ ਹੈ ਕ ਕਾਨੂੰਨ ਵਜੋਂ ਇਸ ਤਰ੍ਹਾਂ ਆਪਾਂ ਦੇਖੀਏ ਚਾਈਲਡ ਲੇਬਰ ਵੀ ਹੈ ਚਾਈਲਡ ਲੇਬਰ ਦੇ ਵਿੱਚ ਆਪਾਂ ਕੀ ਦੇਖ ਸਕਦੇ ਹਾਂ ਕਿ ਕਿਸੀ ਵੀ ਬੱਚੇ ਨੂੰ ਅਠਾਰਾਂ ਸਾਲ ਦੇ ਘੱਟ ਉਮਰ ਦੇ ਬੱਚਿਆਂ ਨੂੰ ਆਪਾਂ ਜੋਬ ਦੇ ਵਿਚ ਕੰਪੇਲ ਨਹੀਂ ਕਰ ਸਕਦੇ ਨੌਕਰੀ ਕਰਨ ਵਾਸਤੇ ਉਹਨਾਂ ਨੂੰ ਨੌਕਰੀ ਕਰਨ ਲਈ ਅਠਾਰਾਂ ਤੋਂ ਵੱਧ ਹੋਣਾ ਚਾਹੀਦਾ ਅਠਾਰਾਂ ਤੋ ਘੱਟ ਕਿਸੇ ਵੀ ਬੱਚੇ ਨੂੰ ਕਿਸੇ ਵੀ ਫੈਕਟਰੀ ਜਾਂ ਕਿਸੇ ਵੀ ਚੀਜ਼ ਦੇ ਵਿਚ ਨੌਕਰੀ ਕਰਦਾ ਫੜੇ ਜਾਂਦੇ ਹੈ ਅਤੇ ਉਸ ਫਰਮ ਦੇ ਉੱਤੇ ਉਸ ਮਾਲਿਕ ਦੇ ਉੱਤੇ ਉਸ ਫੈਕਟਰੀ ਦੇ ਉੱਤੇ ਕਾਨੂੰਨੀ ਕਰਵਾਈ ਕੀਤੀ ਜਾਂਦੀ ਹੈ ਉਹਨੂੰ ਫੜ ਕੇ ਕਈ ਵਾਰੀ ਇਸ ਤਰ੍ਹਾਂ ਦਾ ਵੀ ਨੌਬਤ ਆ ਜਾਂਦਾ ਕਿ ਅਗਰ ਇਸ ਤਰ੍ਹਾਂ ਦਾ ਅਗਰ ਜ਼ਿਆਦਾ ਪੈ ਜਾਂਦਾ ਤਾਂ ਉਹ ਫੈਕਟਰੀ ਨੂੰ ਸੀਲ ਕਰਨ ਦਾ ਵੀ ਨੌਬਤ ਆ ਜਾਂਦਾ ਹੈ ਅਤੇ ਮਾਲਕ ਨੂੰ ਵੀ ਜੇਲ ਦੀ ਸ ਸਜ਼ਾ ਹੁੰਦੀ ਹੈ ਤੀਸਰਾ ਆਪਾਂ ਦੇਖਦੇ ਹਾਂ ਕਿ ਸਰਕਾਰ ਨੇ ਕਾਨੂੰਨ ਪ੍ਰਣਾਲੀ ਨੂੰ ਹਰੇਕ ਪਾਸੇ ਕਾਫੀ ਅੱਛਾ ਬਣਾਇਆ ਹੋਇਆ ਵਾ ਔਰ ਇਸਦੇ ਵਿੱਚ ਮੁਸਤੈਦ ਵੀ ਹੈ ਸਰਕਾਰ ਹਰੇਕ ਚੀਜ਼ ਦੇ ਵਿੱਚ ਪੂਰਾ ਦਾ ਪੂਰਾ ਇਨਵੋਲਵ ਹੈ ਕਿਸੀ ਦੇ ਨਾਲ ਕੋਈ ਨਿਆਂ ਨਾ ਹੋ ਸਕੇ ਅਨਿਆਂ ਦੇ ਖਿਲਾਫ਼ ਸਰਕਾਰ ਨੇ ਹਰੇਕ ਤਰ੍ਹਾਂ ਦਾ ਕਾਨੂੰਨ ਬਣਿਆ ਹੋਇਆ ਵਾ ਇਸ ਕਰਕੇ ਸਰਕਾਰ ਦੇ ਕੀਤੇ ਹੋਏ ਕੰਮ ਨੂੰ ਅਤੇ ਉਹਦੇ ਕੀਤੇ ਹੋਏ ਨੇ ਸਾਨੂੰ ਵੀ ਰਿਸਪੈਕਟ ਕਰਨਾ ਚਾਹੀਦਾ ਔਰ ਫਿਰ ਇਹਨੂੰ ਜਾਰੀ ਰੱਖਣਾ ਚਾਹੀਦਾ